ਮੈਂ ਇੱਕ ਸਿਵਲ ਇੰਜਨੀਅਰ ਹਾਂ ਇਹ ਵੀ ਇੱਕ ਹੁਨਰ ਹੀ ਹੈ ਅਤੇ ਮੈਂ ਪ੍ਰਾਈਵੇਟ ਕੰਮ ਕਰਦੇ ਹੋਏ ਬਿਲਡਿੰਗਾਂ ਦਾ ਠੇਕੇਦਾਰਾਂ ਨਾਲ ਲੱਗ ਕੇ ਇਸ ਹੁਨਰ ਨੂੰ ਵਿਕਸਿਤ ਕੀਤਾ ਜਿਵੇਂ ਕਿ ਮੈਂ ਬਿਲਡਿੰਗਾਂ ਬਣਾਉਣ ਦਾ ਹਰ ਕੰਮ 'ਚ ਮਹਾਰਤ ਹਾਸਿਲ ਕੀਤੀ ਇਸ ਤੋਂ ਇਲਾਵਾ ਉੱਥੇ ਮੇਰੇ ਅੰਡਰ ਹੋਰ ਵੀ ਮਜ਼ਦੂਰ ਅਤੇ ਪਲੰਬਰ ਇਲੈਕਟ੍ਰੀਸ਼ਨ ਜਿਹੜੇ ਕੰਮ ਕਰਦੇ ਸਨ ਉਹਨਾਂ ਨੂੰ ਦੇਖ ਕੇ ਜਾਂ ਉਹਨਾਂ ਤੋਂ ਕੰਮ ਕਰਵਾ ਕੇ ਉਹਨਾਂ ਕੋਲੋਂ ਵੀ ਮੈਨੂੰ ਕਾਫੀ ਕੁਛ ਸਿੱਖਣ ਨੂੰ ਮਿਲਿਆ ਜਿਵੇਂ ਕਿ ਕੋਈ ਪਲੰਬਿੰਗ ਦਾ ਕੰਮ ਹੈ ਮੇਰੇ ਘਰ ਦਾ ਕੋਈ ਕੰਮ ਹੁੰਦਾ ਤਾਂ ਮੈਂ ਉਹ ਆਪ ਕਰ ਸਕਦਾ ਹਾਂ ਕੋਈ ਬਿਜਲੀ ਦਾ ਛੋਟਾ ਕੰਮ ਹੁੰਦਾ ਹੈ ਉਹ ਵੀ ਮੈਂ ਆਪ ਕਰ ਸਕਦਾ ਹਾਂ ਮਤਲਬ ਇਹ ਮੈਂ ਉਹਨਾਂ ਨੂੰ ਦੇਖ ਕੇ ਆਪਣੇ 'ਚ ਇਹ ਹੁਨਰ ਵਿਕਸਿਤ ਕੀਤਾ